ਹਾਂਜੀ ਮਿਊਨਸੀਪਲ ਦਫ਼ਤਰ 'ਚੋਂ ਬੋਲ ਰਹੇ ਹੋ ਜੀ ਅਸੀਂ ਨਾ ਜੀ ਹੰਡਿਆਇਆ ਤੋਂ ਬੋਲ ਰਹੇ ਹਾਂ ਜੀ ਬਰਨਾਲਾ ਵਿਖੇ ਆਪਣੇ ਘਰ ਕੋਲ ਨਾ ਜੀ ਕੂੜਾ ਬਹੁਤ ਜ਼ਿਆਦਾ ਇਕੱਠਾ ਹੋ ਚੁੱਕਿਆ ਕਾਫ਼ੀ ਵਾਰ ਕੋਸ਼ਿਸ਼ ਕਰੀ ਵੀ ਲੋਕਾਂ ਨੂੰ ਰੋਕਿਆ ਜਾਵੇ ਵੀ ਇੱਥੇ ਨਾ ਸੁੱਟੋ ਨਾ ਖੰਡਾਓ ਕਾਫ਼ੀ ਵਾਰ ਤੁਹਾਡੇ ਦਫ਼ਤਰ ਦੇ ਕਰਮਚਾਰੀ ਨਾਲ ਵੀ ਗੱਲ ਕਰੀ ਵੀ ਇਹਦੀ ਸਫਾਈ ਕਰ ਦਿਓ ਤਾਂ ਵਧੀਆ ਗੱਲ ਹੈ ਪਰ ਹੁਣ ਅਖੀਰ ਨੂੰ ਅਸੀਂ ਇਹ ਆਪਣੇ ਉੱਤੇ ਹੀ ਜਿੰਮੇਵਾਰੀ ਲੈ ਲਈ ਵੀ ਅਸੀਂ ਖੁਦ ਹੀ ਨਾਲ ਲੱਗ ਕੇ ਇਹ ਸਾਫ਼ ਸਫਾਈ ਕਰਾਵਾਂਗੇ ਸੋ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਜੀ ਤੁਸੀਂ ਆਪਣੇ ਮੁਲਾਜ਼ਮ ਲੈ ਕੇ ਇੱਥੇ ਪਹੁੰਚੋ ਕਿਉਂਕਿ ਅਸੀਂ ਵੀ ਲੱਗੇ ਹੋਏ ਹਾਂ ਮੁਹੱਲੇ ਵਾਲੇ ਵੀ ਲੱਗੇ ਹੋਏ ਨੇ ਅਤੇ ਤੁਸੀਂ ਵੀ ਇੱਥੇ ਸਾਡੇ ਨਾਲ ਸਾਫ਼ ਸਫਾਈ ਵਿੱਚ ਸਹਿਯੋਗ ਕਰੋ ਕਿਉਂਕਿ ਆਖਰ ਨੂੰ ਚਲੋ ਡਿਊਟੀ ਤਾਂ ਫਿਰ ਵੀ ਨਗਰ ਕੌਂਸਲ ਦੀ ਕਮੇਟੀ ਦੀ ਬਣਦੀ ਹੈ ਤਾਂ ਮਿਉਂਸੀਪਲ ਦਫ਼ਤਰ ਦਾ ਕੰਮ ਹੀ ਹੈ ਅਸੀਂ ਤਾਂ ਚਲੋ ਹੈਲਪ ਵਜੋਂ ਨਾਲ ਕਰਵਾ ਦਿਆਂਗੇ ਤਾਂ ਤੁਸੀਂ ਜ਼ਰੂਰ ਪਹੁੰਚੋ ਜੀ ਸਾਡੇ ਘਰ ਦੇਖੋ ਸਾਈਡਾਂ 'ਤੇ ਕਿੱਡਾ ਕਿੱਡਾ ਘਾਹ ਹੋ ਚੁੱਕਿਆ ਹੈ ਜਾਨਵਰ ਬੈਠੇ ਹੁੰਦੇ ਹਨ ਠੀਕ ਹੈ ਗੰਦ ਆ ਲੋਕ ਕੂੜਾ ਸਿੱਟ ਜਾਂਦੇ ਨੇ ਅਤੇ ਨਾਲੀਆਂ ਕੱਢਣ ਵਾਲੀਆਂ ਪਈਆਂ ਨੇ ਨਾਲੀਆਂ ਦੀ ਕੋਈ ਸਫਾਈ ਨਹੀਂ ਜੀ ਮੀਂਹ ਵੇਲੇ ਸਾਰਾ ਓਵਰ ਫਲੋ ਹੋ ਜਾਂਦਾ ਘਰਾਂ 'ਚ ਪਾਣੀ ਬੜਣ ਤੱਕ ਨੌਬਤ ਆ ਜਾਂਦੀ ਹੈ ਅਤੇ ਦਿਨ ਰਾਤ ਸਮੈਲ ਆਉਂਦੀ ਰਹਿੰਦੀ ਹੈ ਬਹੁਤ ਬੁਰੀ ਲੱਗਦੀ ਹੈ ਜੀ ਕੋਈ ਲੰਘ ਕੋਈ ਰਿਸ਼ਤੇਦਾਰ ਆਇਆ ਕੋਈ ਵਿਆਹ ਸ਼ਾਦੀ ਹੈ ਕੂੜਾ ਖਿੰਡਿਆ ਵੈਸੇ ਹੀ ਬੁਰਾ ਲੱਗਦਾ ਪਰ ਤੁਹਾਨੂੰ ਬੇਨਤੀ ਕਰਦੇ ਹਾਂ ਜੀ ਤੁਸੀਂ ਕਿਰਪਾ ਕਰਕੇ ਆਪਣੇ ਮੁਲਾਜ਼ਮ ਲੈ ਕੇ ਆਓ ਅਤੇ ਇੱਥੋਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਚਾਹ ਪਾਣੀ ਦੀ ਪੂਰੀ ਸੇਵਾ ਕਰਾਂਗੇ ਕੋਈ ਖਾਣ ਪੀਣ ਦਾ ਵੀ ਆਪਾਂ ਅਰੇਂਜਮੈਂਟ ਕਰ ਲਾਂਗੇ ਉਹਨਾਂ ਮੁਲਾਜ਼ਮਾਂ ਵਾਸਤੇ ਬਸ ਉਹਨਾਂ ਨੂੰ ਲੈ ਕੇ ਜ਼ਰੂਰ ਆਇਓ ਤਾਂ ਕਿ ਇੱਥੋਂ ਦੀ ਸਾਫ਼ ਸਫਾਈ ਕਰੀ ਜਾ ਸਕੇ ਅਤੇ ਅਡਰੈਸ ਆਪਣਾ ਜੀ ਆ ਬੁਰਜ ਵਾਲੇ ਡੇਰੇ ਦੇ ਨਾਲ ਆ ਜੀ ਆਪਣਾ ਘਰ ਬੁਰਜਾਂ ਵਾਲਾ ਡੇਰਾ ਵਾਰਡ ਨੰਬਰ ਪੰਜ ਕਾਰਨਰ ਦੇ ਉੱਤੇ ਹੀ ਹੈ ਜੀ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਹੈ ਤਾਂ ਤੁਸੀਂ ਕਿਰਪਾ ਕਰਕੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਟਰੈਕਟਰ ਟਰਾਲੀ ਜਿਹਦੇ ਉੱਤੇ ਬ ਕਾਫ਼ੀ ਕੂੜਾ ਲੱਦਿਆ ਜਾ ਸਕੇ ਰੇਹੜੀਆਂ ਲੈ ਕੇ ਆਉਣ ਮੁਲਾਜ਼ਮ ਆਪਣੀਆਂ ਕਹੀਆਂ ਵਗੈਰਾ ਲੈ ਆਉਣ ਝਾੜੂ ਵਗੈਰਾ ਲੈ ਆਉਣ ਚਾਹ ਪਾਣੀ ਦਾ ਇੰਤਜਾਮ ਇੱਥੇ ਰੱਖਾਂਗੇ ਆਪਾਂ ਨਾਲ ਲੱਗ ਜਾਵਾਂਗੇ ਹੈਲਪ ਕਰਾ ਦਿਆਂਗੇ ਜੀ ਤੇ ਤਾਂ ਕਿ ਮੁਹੱਲੇ ਦੀ ਸਫਾਈ ਹੋ ਸਕੇ ਅਤੇ ਸਾਫ਼ ਸਫਾਈ ਨਾਲ ਹੀ ਮੁਹੱਲਾ ਸੋਹਣਾ ਲੱਗਦਾ ਹੈ ਜੀ ਠੀਕ ਹੈ ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਕਾਫ਼ੀ ਖਤਰਾ ਘੱਟ ਜਾਂਦਾ ਜੀ ਸਾਫ਼ ਸਫਾਈ ਹੋਵੇਗੀ ਨਹੀਂ ਤਾਂ ਹੁਣ ਨਾਲੀਆਂ ਗਲੀਆਂ ਬੰਦ ਪਈਆਂ ਨੇ ਜੀ ਇੱਥੇ ਮੱਛਰ ਪੈਲ ਬਹੁਤ ਜ਼ਿਆਦਾ ਪੈਦਾ ਹੋ ਰਿਹਾ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਇਸ ਲਈ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਆਪਣਾ ਫਰਜ਼ ਸਮਝਦੇ ਹੋਏ ਜਾਂ ਸਾਡੀ ਐਂ ਲਗਾ ਲਓ ਵੀ ਬੇਨਤੀ ਮੰਨਦੇ ਹੋਏ ਇੱਥੇ ਪਹੁੰਚੋ ਮੁਲਾਜ਼ਮਾਂ ਦੇ ਨਾਲ ਪਹੁੰਚੋ ਸਾਫ਼ ਸਫਾਈ ਵਿਚ ਅਸੀਂ ਤੁਹਾਡਾ ਪੂਰਨ ਸਹਿਯੋਗ ਦੇਵਾਂਗੇ ਜੀ ਆਪਾਂ ਰਲ ਮਿਲ ਕੇ ਇਸ ਕੂੜੇ ਕਰਕਟ ਤੋਂ ਨਿਯਾਤ ਪਾ ਸਕੀਏ ਅਤੇ ਆਪਣੇ ਆਲਾ ਦੁਆਲੇ ਨੂੰ ਸਾਫ਼ ਬਣਾਉਣ ਵਿੱਚ ਜਿਸ ਤਰ੍ਹਾਂ ਲੋਕ ਯੋਗਦਾਨ ਪਾ ਰਹੇ ਨੇ ਉਸ ਤਰ੍ਹਾਂ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਇਓ ਜੀ ਧੰਨਵਾਦ